ਕੁਝ ਦਿਨ ਪਹਿਲੇ ਮੈਂ ਇੱਕ ਗੈਸ ਚੁੱਲ੍ਹਾ ਲੈ ਕੇ ਆਈ ਸੀ ਜੋ ਬਹੁਤ ਹੀ ਮਤਲਬ ਗ਼ਲਤ ਨਿਕਲ ਗਿਆ ਵੇਸਟ ਬਿਲਕੁਲ ਵੀ ਅੱਛੀ ਕੁਆਲਿਟੀ ਨਹੀਂ ਬਹੁਤ ਹਲਕਾ ਮਟੀਰੀਅਲ ਲੱਗਿਆ ਔਰ ਜੋ ਉਸਦੇ ਬਰਨਲ ਹੈ ਉਹਨਾਂ ਵਿੱਚੋਂ ਕਈ ਵਾਰ ਇਕਦਮ ਤੋਂ ਤੇਜ਼ ਅੱਗ ਨਿਕਲਣ ਲੱਗ ਜਾਂਦੀ ਹੈ ਔਰ ਕਈ ਵਾਰ ਬਿਲਕੁਲ ਹੀ ਧੂੰਆਂ ਛੱਡਣ ਲੱਗ ਜਾਂਦੇ ਔਰ ਉਹ ਗੈਸ ਵੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਉਹਦੇ ਵਿੱਚ ਜੋ ਕਿ ਮਤਲਬ ਗੈਸ ਵਾਸਤੇ ਵੀ ਬਹੁਤ ਠੀਕ ਨਹੀਂ ਹੈ ਔਰ ਵੈਸੇ ਵੀ ਉਹ ਖ਼ਤਰਾ ਮਤਲਬ ਦੇਖਣ 'ਚ ਵੀ ਉਹਨਾਂ ਤੋਂ ਐਂ ਲੱਗਦਾ ਵੀ ਉਹ ਖ਼ਤਰੇ ਦਾ ਕੰਮ ਹੈ ਕਦੀ ਵੀ ਕੁਛ ਵੀ ਹੋ ਸਕਦਾ ਉਹਨਾਂ ਦੀ ਮਤਲਬ ਪਾਈਪ ਲ ਵੀ ਠੀਕ ਨਹੀਂ ਹੈ ਉਸ 'ਚ ਵੀ ਲੀਕੇਜ ਹੋਈ ਕਈ ਵਾਰ ਮਤਲਬ ਪੈਸੇ ਹੀ ਵੇਸਟ ਹੋਏ ਆ ਉਹਨਾਂ ਨੂੰ ਲੈ ਕੇ ਕੁਛ ਖ਼ਾਸ ਨਹੀਂ ਨਿਕਲੇ